ਸਮੇਂ ਦੇ ਨਾਲ਼ ਉਦਯੋਗ ਅਤੇ ਕਾਰੋਬਾਰ ਬਹੁਤ ਹੀ ਜ਼ਿਆਦਾ ਵਿਕਸਿਤ ਹੋਏ ਹਨ ਜਿਵੇਂ ਉਦਯੋਗ ਵਿੱਚ ਖੇਤ ਪਿੰਡਾਂ ਵਿੱਚ ਡੇਅਰੀ ਫਾਰਮ ਆਦਿ ਬਹੁਤ ਹੀ ਉਦਯੋਗ ਉਦਯੋਗਿਕ ਸਾਧਨ ਹੈ ਅਤੇ ਕਾਰੋਬਾਰ ਵਿੱਚ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਨੇੜੇ ਵੱਖ ਵੱਖ ਏਜੰਸੀਆਂ ਅਤੇ ਕੰਪਨੀਆਂ ਦਾ ਆਉਣਾ ਬਹੁਤ ਹੀ ਜ਼ਿਆਦਾ ਕਾਰੋਬਾਰ ਵਿਕਸਿਤ ਕਰਨ ਵਿੱਚ ਲਾਭਦਾਇਕ ਸਿੱਧ ਹੋਇਆ ਹੈ ਇਸ ਦੇ ਨਾਲ ਹੀ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਪਹਿਲਾ ਪਹਿਲੇ ਜ਼ਮਾਨੇ ਵਿੱਚ ਕ ਆਵਾਜਾਈ ਦੇ ਸਾਧਨ ਘੱਟ ਹੋਣ ਕਾਰਨ ਲੋਕ ਪਿੰਡਾਂ ਤੋਂ ਕਾਫੀ ਕਾਫੀ ਦਿਨ ਦੂਰ ਰਹਿੰਦੇ ਸਨ ਅਤੇ ਘਰ ਪਰਤਦੇ ਸਮੇਂ ਬਹੁਤ ਹੀ ਸਮਾਂ ਲੱਗ ਜਾਂਦਾ ਸੀ ਪਰ ਅੱਜ ਕੱਲ੍ਹ ਸਮੇਂ ਦੇ ਨਾਲ਼ ਨਾਲ਼ ਆਵਾਜਾਈ ਦੇ ਸਾਧਨ ਵੱਧ ਹੋਣ ਕਾਰਨ ਇਹ ਚੁਣੌਤੀਆਂ ਵੀ ਖਤਮ ਕੀਤੀਆਂ ਗਈਆਂ ਹਨ ਅਤੇ ਆਰਥਿਕ ਵਿਕਾਸ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਕੀਤਾ ਗਿਆ ਹੈ